ਪਹਿਲਾਂ ਤਾਂ ਅਸੀਂ ਗਾਉਣ ਤੋਂ ਸਾਰੇ ਸਾਥੀ ਜਾਂ ਬੈਂਡ ਰਲ ਕੇ ਪਹਿਲਾਂ ਰਿਹਰਸਲ ਕਰਦੇ ਹਾਂ ਰਿਹਰਸਲ ਵਿੱਚ ਅਸੀਂ ਜੋ ਜੋ ਗਾਣਾ ਗਾਣਾ ਹੁੰਦਾ ਹੈ ਕਿਸ ਸਕੇਲ 'ਤੇ ਗਾਣਾ ਹੁੰਦਾ ਹੈ ਕਿਹੜਾ ਨੋਟ ਚੱਕਣਾ ਹੁੰਦਾ ਹੈ ਉਸ ਚੀਜ਼ ਦੀ ਪਹਿਲਾਂ ਪ੍ਰੈਕਟਿਸ ਕਰ ਲੈਂਦੇ ਹਾਂ ਤਾਂ ਕਿ ਸਾਨੂੰ ਗਾਉਂਦੇ ਸਮੇਂ ਕੋਈ ਵੀ ਦਿੱਕਤ ਨਾ ਆਵੇ ਅਤੇ ਗਾਉਂਦੇ ਸਮੇਂ ਮੈਂ ਆਪਣੇ ਸਾਥੀ ਜਾਂ ਬੈਂਡ ਨਾਲ ਇੱਕ ਇਸ਼ਾਰਾ ਰੱਖਦਾ ਹਾਂ ਕਿਤੇ ਸਕੇਲ ਉੱਪਰ ਲੈ ਕੇ ਜਾਣਾ ਹੈ ਜਾਂ ਜਿੱਥੇ ਸਕੇਲ ਨੀਵਾਂ ਲੈ ਕੇ ਜਾਣਾ ਹੈ ਜਾਂ ਕਿਹੜਾ ਨੋਟ ਚੱਕਣਾ ਹੈ ਇਹ ਸਭ ਦਾ ਇੱਕ ਅਸੀਂ ਰੱਖਿਆ ਹੁੰਦਾ ਹੈ ਕਿ ਜਦੋਂ ਮੈਂ ਇੱਦਾਂ ਐਂ ਇਸ਼ਾਰਾ ਕਰੂੰਗਾ ਤਾਂ ਤੁਸੀਂ ਇਹ ਸਕੇਲ ਚੱਕ ਲਿਓ ਠੀਕ ਹੈ ਅਤੇ ਜਾਂ ਅਸੀਂ ਇੱਕ ਸ਼ੋ ਚਲਦੇ ਦੇ ਵਿੱਚ ਜਾਂ ਗਾਣਾ ਗਾਉਂਦੇ ਸਮੇਂ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਰੱਖਦੇ ਹਾਂ ਤਾਂ ਕਿ ਜੇਕਰ ਕਿਸੇ ਤੋਂ ਵੀ ਗਲਤੀ ਹੋਵੇ ਤਾਂ ਅਸੀਂ ਰਲ ਕੇ ਉਹ ਗਲਤੀ ਨੂੰ ਸੁਧਾਰ ਲਈਏ ਜਾਂ ਪਤਾ ਨਾ ਲੱਗਣ ਦਈਏ ਅਗਲੇ ਨੂੰ ਅਤੇ ਇਸ ਨਾਲ ਤਾਲਮੇਲ ਨਾਲ ਜੋ ਕਿ ਬਹੁਤ ਜ਼ਰੂਰੀ ਹੈ ਹੋਣਾ ਜਦੋਂ ਆਪਾਂ ਗਾ ਰਹੇ ਹਾਂ ਆਪਣੇ ਸਾਥੀਆਂ ਨਾਲ ਜਾਂ ਬੈਂਡ ਦੇ ਨਾਲ ਜੇਕਰ ਉਹ ਤਾਲਮੇਲ ਆਪਣੇ 'ਚ ਨਹੀਂ ਹੋਵੇਗਾ ਤਾਂ ਉਹ ਚੀਜ਼ ਆਪਾਂ ਨੂੰ ਖਰਾਬ ਕਰ ਦੇਗੀ ਅਤੇ ਸ਼ਾਇਦ ਕਿਤੇ ਨਾ ਕਿਤੇ ਜੋ ਆਪਾਂ ਦਿਖਾਉਣਾ ਚਾਹੁੰਦੇ ਹਾਂ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹਾਂ ਉਹ ਸਹੀ ਤਰ੍ਹਾਂ ਅਗਲੇ ਤੱਕ ਪਹੁੰਚ ਨਹੀਂ ਪਾਏਗਾ ਅਤੇ ਇਹ ਤਾਲਮੇਲ ਦੀ ਪ੍ਰੈਕਟਿਸ ਰਿਹਰਸਲ ਬਹੁਤ ਜ਼ਰੂਰੀ ਹੈ ਅਤੇ ਬਾਕੀ ਅਸੀਂ ਕੁਛ ਨਾ ਕੁਛ ਇਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹਦੇ ਨਾਲ ਅਸੀਂ ਪਹਿਲਾਂ ਤੋਂ ਹੀ ਜਾਣ ਸਕਦੇ ਹੋਈਏ ਕਿ ਅਸੀਂ ਕਰਨਾ ਕੀ ਹੈ